ਪੇਂਟਿੰਗ ਮੈਨੂੰ ਬੜੀ ਪਸੰਦ ਆ ਪੇਂਟਿੰਗ ਕਰਨਾ ਅਲੱਗ ਅਲੱਗ ਕਲਰਾਂ ਨੂੰ ਇਕੱਠੇ ਇੱਕ ਬਣਾਉਣਾ ਕਿਹੜੇ ਕਲਰ ਕਿਹੜੇ ਵਿੱਚੋਂ ਬਣਦੇ ਨੇ ਮੈਨੂੰ ਬੜਾ ਸ਼ੌਂਕ ਹੈ ਪੇਟਿੰਗ ਦਾ ਵਾ ਮੈਨੂੰ ਜਿਵੇਂ ਕਿ ਮੈਨੂੰ ਹੋਈ ਤਾਂ ਪਲੱਸ ਟੂ ਪੇਂਟਿੰਗ ਦੁਬਾਰਾ ਹੀ ਵਿੱਚ ਪੜ੍ਹਦੀ ਪੜ੍ਹਦੀ ਪੇਂਟਿੰਗ ਸਿੱਖਦੀ ਹੁੰਦੀ ਸੀ ਪੇਂਟਿੰਗ ਸਿੱਖਣਾ ਮੈਨੂੰ ਬੜਾ ਹੀ ਪਸੰਦ ਆ ਉਹਨਾਂ ਬਾਰੇ ਰੰਗਾਂ ਬਾਰੇ ਜਾਨਣਾ ਅਲੱਗ ਅਲੱਗ ਕਲਾ ਕਰਨੀਆਂ ਅਲੱਗ ਅਲੱਗ ਫਲਾਵਰ ਜਾਂ ਇੱਦਾਂ ਦੇ ਫੁੱਲ ਬਣਾਉਣੇ ਪੇਂਟਿੰਗ 'ਤੇ ਜਿਵੇਂ ਫਲਾਵਰ ਬਣਾਉਣੇ ਅਤੇ ਅਲੱਗ ਅਲੱਗ ਡਿਜ਼ਾਇਨਰ ਕਈ ਤਰ੍ਹਾਂ ਦੀਆਂ ਦੇਖ ਕੇ ਮੈਂ ਪ੍ਰਦਰਸ਼ਨਾਂ ਵੀ ਦੇਖਦੀ ਹਾਂ ਉਹਨਾਂ ਦੇ ਵਿੱਚੋਂ ਦੇਖਦੀ ਹਾਂ ਵੱਖ ਵੱਖ ਰੰਗ ਸ਼ੈਲੀਆਂ ਨੂੰ ਨਵੀਂ ਸੋਚ ਅਤੇ ਉਹ ਵੀ ਪ੍ਰੇਰਨਾ ਲੈਂਦੀ ਆ ਕਈ ਕਲਾ ਸਮਝਣ ਦੀ ਕੋਸ਼ਿਸ਼ ਹਾਂ ਕਲਾਕਾਰ ਰੰਗ ਕਰਕੇ ਕਲਾਕਾਰੀ ਕਹਿੰਦੇ ਵੀ ਸਮਝਣ ਦੀ ਕੋਸ਼ਿਸ਼ ਕਰਦੀ ਹੈ ਕਿ ਇਹਦੇ ਵਿੱਚ ਕੀ ਅਨੁਭਵ ਹੁੰਦਾ ਹੈ ਸਾਨੂੰ ਇਸ ਕਲਾ ਦੇ ਵਿੱਚ ਕੀ ਪਸੰਦ ਕੀ ਸੋਚ ਕੀ ਇਹਦੇ ਵਿੱਚ ਸਾਨੂੰ ਕਲਾ ਦੱਸਦੀ ਹੈ ਅਤੇ ਇਹਨਾਂ ਨੂੰ ਮਨ ਵਿੱਚ ਕਈ ਵਾਰ ਪ੍ਰਸ਼ਨ ਵੀ ਉੱਠਦੇ ਹਨ ਕਈ ਵਾਰ ਮਹਿਸੂਸ ਕਲਾਕਾਰ ਕਰਕੇ ਮਹਿਸੂਸ ਕੀਤਾ ਜਾਂਦਾ ਹੈ ਇਹ ਕੋਈ ਕਈ ਵਾਰ ਤਾਂ ਆਪਣੇ ਦਾਵੇ ਕਹਾਣੀ ਰਚਨਾ ਵੀ ਹੋ ਸਕਦੀ ਹੈ ਹੋਰ ਕਲਾ ਗੱਲਬਾਤ ਕਰਨਾ ਸਾਨੂੰ ਕਾਫੀ ਸਮਝ ਨਾ ਕਲਾਕਾਰਾਂ ਨਾਲ ਸਮਝਣ ਦੀ ਸਮਝ ਮਿਲਦੀ ਹੈ ਸਮਝਾ ਦਿੱਤਾ ਵੀ ਮੌਕਾ ਕਈ ਅਤੇ ਅੰਦ ਅੰਦਾਜ਼ ਸਮਝਿਆ ਮੌਕਾ ਵੀ ਮਿਲਦਾ ਹੈ ਅਤੇ ਸਾਨੂੰ ਕਲਾ ਕੁਝ ਕਲਾਕਰ ਕਰਦੀਆਂ ਜਿਹੜਾ ਡੂੰਘੀ ਡੂੰਘਾਈ ਵਿੱਚ ਜਾਣ ਦੀ ਵੀ ਲੋੜ ਹੁੰਦੀ ਹੈ ਉਹਨਾਂ ਨੂੰ ਸਮਝਣਾ ਡੂੰਘੇ ਹਿਸਾਬ 'ਚ ਜਾਣ ਦੀ ਵੀ ਲੋੜ ਹੁੰਦੀ ਹੈ ਜਿਵੇਂ ਕਿ ਕਲਾ ਦੇ ਹਿਸਾਬ ਨਾਲ ਸਾਨੂੰ ਕਈ ਰੰਗਾਂ ਦੇ ਵਿੱਚ ਹਰੇਕ ਰੰਗ ਦਾ ਅਲੱਗ ਅਲੱਗ ਅਟੈਚਮੈਂਟ ਹੁੰਦੀ ਹੈ ਅਲੱਗ ਅਲੱਗ ਸਾਨੂੰ ਇਸ ਬਾਰੇ ਦੱਸਦੇ ਹਨ ਇਹ ਤਾਂ ਕਈ ਕਲਾ ਗੈਲਰੀ ਪ੍ਰਦਰਸ਼ਨ ਤਾਂ ਆਉਂਦੇ ਸਿਰਫ ਦਿਸ਼ਟੀਕੋਣ ਨਹੀਂ ਸਗੋਂ ਕਈ ਦ੍ਰਿਸ਼ਟੀ ਕੋਣ ਨਹੀਂ ਸਗੋਂ ਸਾਨੂੰ ਅਲੱਗ ਅਨੁਭਵ ਹੁੰਦਾ ਹੈ ਮਨ ਵਿੱਚ ਕਈ ਰੰਗ ਨਵੇਂ ਨਵੇਂ ਉੱਡਦੇ ਹਨ ਭਾਵਨਾਵਾਂ ਅਲੱਗ ਅਲੱਗ ਹੁੰਦੀਆਂ ਹਨ ਵਿਚਾਰ ਹਰੇਕ ਰੰਗ ਹਰੇਕ ਕਲਰ ਅਤੇ ਹਰੇਕ ਤਸਵੀਰ ਹਰੇਕ ਫਲਾਵਰ ਅਲੱਗ ਅਲੱਗ ਤਰ੍ਹਾਂ ਦੇ ਮੰਨ ਲਓ ਵਿਚਾਰਦਾ ਹੁੰਦੇ ਹਨ ਅਤੇ ਉਹ ਜਿਹੜੇ ਆਪਣੇ ਵਿਚਾਰਾਂ ਫਿਰ ਆਪਾਂ ਨੂੰ ਕਲਾਕਾਰੀ 'ਤੇ ਵੀ ਕਈ ਵਾਰ ਪ੍ਰੇਰਨਾ ਦਿੰਦੇ ਉਤਾਰਦੇ ਨੇ ਜਿਹੜੇ ਆਪਣੇ ਮਨ ਵਿੱਚ ਹਾਓ ਭਾਓ ਹੁੰਦੇ ਹਨ ਉਹ ਕਈ ਵਾਰ ਅਸੀਂ ਰੰਗਾਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਦਰਸ਼ਨ ਕਰਦੇ ਹਾਂ ਕਿ ਭਾਵ ਕਰਦੀ ਹਾਂ